ਹੈਲੋ ਨਮਸਤੇ ਜੀ ਹਾਂਜੀ ਹਾਂਜੀ ਹਾਂਜੀ ਮੈਮ ਮੇਰੇ ਕੋਲ ਬੈਚਿਸ ਹੈਗੇ ਹੈ ਇਸ ਟਾਈਮ ਮੇਰੇ ਕੋਲ ਤਿੰਨ ਬੈਚ ਚੱਲ ਰਹੇ ਹੈ ਇੱਕ ਤਾਂ ਸੂਬਹਾ ਸਿਕਸ ਓ ਕਲੋਕ ਹੈਗਾ ਹੈ ਅਤੇ ਉਸ ਤੋਂ ਬਾਅਦ ਇਹ ਵੈਸੇ ਇੱਕ ਘੰਟੇ ਦੀ ਕਲਾਸ ਹੁੰਦੀ ਹੈ ਹਾਂਜੀ ਏਕ ਸਿਕਸ ਓ ਸਿਕਸ ਓ ਕਲੋਕ ਹੈ ਉਸ ਤੋਂ ਬਾਅਦ ਨਾਈਨ ਓ ਕਲੋਕ ਹੈ ਅਤੇ ਫਿਰ ਉਸ ਤੋਂ ਬਾਅਦ ਈਲੈਵਨ ਓ ਕਲੋਕ ਹੈ

ਹਾਂਜੀ ਹਾਂਜੀ ਅੱਛਾ ਅਤੇ ਫਿਰ ਤੁਸੀਂ ਮੈਨੂੰ ਦੱਸ ਦੇਣਾ ਕਦੋਂ ਤੋਂ ਸਟਾਰਟ ਕਰਨਾ ਐਂਡ ਅਤੇ ਸੂਬਹਾ ਦਾ ਹੀ ਤੁਸੀਂ ਰੱਖਣਾ ਫਿਰ ਬੈਚ ਹਾਂਜੀ ਤਾਂ ਫੇਰ ਤੁਹਾਨੂੰ ਇਹਦੇ ਲਈ ਮਤਲਬ ਤੁਹਾਨੂੰ ਪੂਰਾ ਸਿਕਸ ਓ ਕਲੋਕ ਉਹਨਾਂ ਨੂੰ ਰੇਡੀ ਕਰਨਾ ਹੋਏਗਾ ਇੱਥੇ ਭੇਜਨਾ ਹੋਏੇਗਾ ਉਸ ਤੋਂ ਬਾਅਦ ਰਿਸਪੋਂਸਬਿਲਟੀ ਇਹ ਹੈ ਕਿ ਤੁਹਾਡੀ ਕਿ ਤੁਸੀਂ ਉਹਨਾਂ ਨੂੰ ਪਹਿਲਾਂ ਆਪਣਾ ਹੈ ਨਾ ਸਾਰਾ ਡਾਈਟ ਵਗੈਰਾ ਪ੍ਰੋਪਰ ਸੂਬਹਾ ਦੇਣੀ ਹੈ ਇੱਕ ਗਲਾਸ ਦੁੱਧ ਸੂਬਹਾ ਦੇਣਾ ਹੀ ਦੇਣਾ ਹਾਂਜੀ ਅਤੇ ਉਸ ਤੋਂ ਬਾਅਦ ਫਰੂਟ ਵੀ ਉਹਨਾਂ ਨੂੰ ਦੇਣੇ ਹੈ ਸੂਬਹਾ ਉਸ ਤੋਂ ਬਾਅਦ ਤੂੰ ਉਹਨਾਂ ਨੂੰ ਇਧਰ ਯੋਗਾ ਕਲਾਸੀਸ ਭੇਜਣਾ ਹੈ ਫਿਰ ਉਸ ਤੋਂ ਬਾਅਦ ਸਾਡੀ ਰਿਸਪੋਂਸਬਿਲਟੀ ਹੈ ਹਾਂਜੀ ਸ਼ੇਮ ਹਾਂਜੀ ਹਾਂਜੀ ਜ਼ਰੂਰ ਫੇਰ ਹਾਂਜੀ ਬਾਕੀ ਮੈਂ ਤੁਹਾਨੂੰ ਸਾਰਾ ਕੁਛ ਭੇਜ ਦਾਂਗੀ ਐਂਡ ਚਾਰਜਿਸ ਵਗੈਰਾ ਵੀ ਮੈਂ ਤੁਹਾਨੂੰ ਇਹਦੇ ਦੱਸ ਦਿੰਦੀ ਹਾਂ ਚਾਰਜਿਸ ਹੈਗੇ ਹੈ ਮਤਲਬ ਫਾਈਵ ਹੰਡਰਡ ਵਨ ਮੰਥ ਦਾ ਹੈ ਹਾਂਜੀ ਫੀਸ ਹੈ ਦੋਨਾਂ ਦੀ ਫਾਈਵ ਹੰਡਰਡ ਉਹਨਾਂ ਦੀ ਹੋਏਗੀ ਅਤੇ ਫਾਈਵ ਹੰਡਰਡ ਤੁਹਾਡੇ ਦੂਸਰੇ ਹੈ ਨਾ ਬੇਬੀ ਦੀ ਹੋਏਗੀ ਮਤਲਬ ਦੋਨਾਂ ਦੀ ਫਾਈਵ ਫਾਈਵ ਹੰਡਰਡ ਫੀ ਹੈ ਵਨ ਮੰਥ ਦੀ ਹਾਂਜੀ ਅਤੇ ਬਾਕੀ ਡਾਈਟ ਵਗੈਰਾ ਵੀ ਮੈਂ ਤੁਹਾਨੂੰ ਦੱਸ ਦਾਂਗੀ ਉਹਨਾਂ ਨੂੰ ਕੀ ਦੇਣੀ ਹੈ ਅਤੇ ਸੂਬਹਾ ਸਿਕਸ ਓ ਕਲੋਕ ਪ੍ਰੋਪਰ ਤੁਸੀਂ ਉਹਨਾਂ ਨੂੰ ਭੇਜਣਾ ਹੀ ਹੈ ਹਾਂਜੀ ਹਾਂਜੀ